ਉਹ ਲੋਕ ਜੋ ਲੜਾਈਆਂ ਦੇ ਹਿੱਸੇ ਵਜੋਂ ਦੂਜੇ ਖੇਤਰ ਵਿੱਚ ਗਏ ਅਤੇ ਉੱਥੇ ਹੀ ਉੱਥੋਂ ਦੇ ਵਸਨੀਕ ਬਣ ਗਏ ਉਹਨਾਂ ਵਿੱਚ ਇੱਕ ਤਾਂ ਆਰਿਅਨ ਲੋਕ ਨੇ ਜੋ ਕਿ ਮਧ ਯੂਰਪ 'ਚੋਂ ਆਏ ਦੱਸੇ ਗਏ ਨੇ ਵੀ ਮਧ ਯੂਰੋਪ 'ਚੋ ਆਏ ਸੀ ਅਤੇ ਇੱਥੇ ਏਸ਼ੀਆ ਨੂੰ ਜਿੱਤਣ ਤੋਂ ਬਾਅਦ ਇੰਡੀਆ ਨੂੰ ਜਿੱਤਣ ਤੋਂ ਬਾਅਦ ਉਹ ਇੱਥੇ ਹੀ ਵੱਸ ਗਏ ਅਜਿਹੇ ਲੋਕ ਜੋ ਦੂਸਰੇ ਖੇਤਰਾਂ 'ਚੋਂ ਲੜਾਈਆਂ ਦੇ ਹਿੱਸੇ ਵਜੋਂ ਆਉਂਦੇ ਨੇ ਅਤੇ ਉੱਥੇ ਹੀ ਵੱਸ ਜਾਂਦੇ ਨੇ ਉਹਨਾਂ ਨੂੰ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲੀ ਚੁਣੌਤੀ ਤਾਂ ਇਹ ਹੁੰਦੀ ਹੈ ਜਿਸ ਤਰ੍ਹਾਂ ਕੇ ਆਰੀਅਨ ਲੋਕ ਆਏ ਉਹ ਠੰਡੇ ਮੁਲਕ ਤੋਂ ਆਏ ਸੀ ਇੱਥੇ ਗਰਮ ਇਲਾਕੇ ਵਿੱਚ ਉਹਨੂੰ ਰਹਿਣ ਵਾਸਤੇ ਸਰਵਾਈਵ ਕਰਨ ਵਾਸਤੇ ਆਪਣੇ ਆਪ ਨੂੰ ਉਸ ਮੌਸਮ ਦੇ ਅਨੁਸਾਰ ਉਹਨਾਂ ਨੂੰ ਢਾਲਣ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੂਸਰਾ ਖਾਣ ਪੀਣ ਵਿੱਚ ਬਹੁਤ ਫ਼ਰਕ ਅੰਤਰ ਆ ਗਿਆ ਉੱਥੇ ਉਹ ਗਰਮ ਚੀਜ਼ਾਂ ਖਾਂਦੇ ਸੀ ਇੱਥੇ ਆ ਕੇ ਉਹਨਾਂ ਨੂੰ ਅਜਿਹਾ ਭੋਜਨ ਲੈਣਾ ਪਿਆ ਜੋ ਇੱਥੋਂ ਦੇ ਭੂਗੋਲਿਕ ਸਥਿਤੀ ਦੇ ਅਨੁਕੂਲ ਸੀ ਉਸ ਤੋਂ ਇਲਾਵਾ ਉਹਨਾਂ ਨੂੰ ਭਾਸ਼ਾ ਨਵੀਂ ਭਾਸ਼ਾ ਸਿੱਖਣੀ ਪਈ ਆਪਣੀ ਭਾਸ਼ਾ ਦੇ ਕੁਛ ਸ਼ਬਦ ਉਹਨਾਂ ਨੇ ਆਪਣੀ ਭਾਸ਼ਾ ਨੂੰ ਦਿੱਤੇ ਕੁਛ ਆਪਣੀ ਲੋਕਲ ਭਾਸ਼ਾ ਦੇ ਸ਼ਬਦ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਲਏ ਇਸ ਤਰ੍ਹਾਂ ਰਚ ਮਿਚ ਗਏ ਉਹ ਆਪਣੇ ਵਿੱਚ ਉਸ ਉਹਨਾਂ ਚੁਣੌਤੀਆਂ ਨੂੰ ਨਜਿੱਠਦੇ ਹੋਏ ਉਹ ਇੱਥੇ ਰਹਿਣ ਲੱਗ ਪਏ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਨੇ ਵੀ ਕਈ ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਕਈ ਲੜਾਈਆਂ ਲੜੀਆਂ ਮੁਗਲਾਂ ਨਾਲ ਲੜਾਈਆਂ ਲੜੀਆਂ ਅਤੇ ਜੋ ਸਿੱਖ ਉਹਨਾਂ ਲੜਾਈਆਂ ਦੇ ਵਿੱਚ ਸ਼ਾਮਲ ਹੋਏ ਉਹ ਪਹਾੜਾਂ ਦੇ ਵਿੱਚ ਹੀ ਵੱਸ ਗਏ ਕਈ ਜੰਮੂ ਕਸ਼ਮੀਰ 'ਚ ਹੀ ਵੱਸ ਗਏ ਕਈ ਲੜਾਈਆਂ ਜੋ ਲੰਮੀਆਂ ਲੜਾਈਆਂ ਚੱਲੀਆਂ ਉਹ ਉੱਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਵੱਸ ਗਏ ਜੋ ਕਿ ਅੱਜ ਵੀ ਉੱਥੇ ਹੀ ਰਹਿ ਰਹੇ ਹਨ ਉਹਨਾਂ ਨੇ ਵੀ ਆਪਣਾ ਏਰੀਆ ਛੱਡ ਕੇ ਉੱਥੇ ਰਿਹਾਇਸ਼ ਸ਼ੁਰੂ ਕਰ ਲਈ ਲੜਾਈਆਂ ਦੇ ਹਿੱਸੇ ਵਜੋਂ ਉੱਥੇ ਗਏ ਸੀ ਪਰ ਉੱਥੋਂ ਦੇ ਵਸਨੀਕ ਹੀ ਬਣ ਗਏ ਉਹਨਾਂ ਨੂੰ ਵੀ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਪਲੇਨ ਏਰੀਏ ਵਿਚ ਰਹਿਣ ਦੇ ਆਦੀ ਸੀਗੇ ਉਹਨਾਂ ਨੂੰ ਪਹਾੜਾਂ 'ਚ ਸਰਵਾਈਵ ਕਰਨਾ ਪਿਆ ਉ ਉੱਥੋਂ ਦੇ ਮੌਸਮ ਦੇ ਵਿੱਚ ਢਲਣਾ ਪਿਆ ਠੰਡੇ ਮੌਸਮ ਦੇ ਵਿੱਚ ਚਲੇ ਗਏ ਉੱਥੋਂ ਦਾ ਖਾਣ ਪੀਣ ਅਡੋਪਟ ਕੀਤਾ ਉਹਨਾਂ ਨੇ ਅਤੇ ਉੱਥੋਂ ਦੀ ਭਾਸ਼ਾ ਉਹਨਾਂ ਨੂੰ ਸਿੱਖਣੀ ਪਈ ਇਹ ਆਮ ਚੁਣੌਤੀਆਂ ਹਨ ਜਦੋਂ ਇੱਕ ਕੋਈ ਯੁੱਧ ਦਾ ਸਿਪਾਹੀ ਜਾਂ ਕੋਈ ਵਿਅਕਤੀ ਆਪਣਾ ਇਲਾਕਾ ਛੱਡ ਕੇ ਦੂਸਰੇ ਇਲਾਕੇ ਵਿੱਚ ਰਹਿਣ ਚਲਾ ਜਾਂਦਾ ਹੈ ਤਾਂ ਉਸ ਨੂੰ ਇਹ ਤਿੰਨ ਚਾਰ ਪਰੇਸ਼ਾਨੀਆਂ ਤਾਂ ਆਉਂਦੀਆਂ ਹੀ ਹਨ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਉਹਨੂੰ ਕਰਨਾ ਪੈਂਦਾ ਹੈ ਸਰਵਾਈਵ ਕਰਨ ਵਾਸਤੇ ਜਿਸ ਤਰ੍ਹਾਂ ਕਿ ਮੌਸਮ ਬਦਲ ਜਾਂਦਾ ਹੈ ਭਾਸ਼ਾ ਨਵੀਂ ਸ਼ਿਖਣੀ ਪੈਂਦੀ ਹੈ ਖਾਣ ਪੀਣ ਨਵਾਂ ਧਾਰਨ ਕਰਨਾ ਪੈਂਦਾ ਹੈ ਇੱਥੋਂ ਤੱਕ ਕਿ ਉਹਨਾਂ ਦੇ ਪਹਿਰਾਵੇ ਵਿੱਚ ਵੀ ਥੋੜ੍ਹਾ ਬਹੁਤ ਉੱਥੋਂ ਦਾ ਲੋਕਲ ਜੋ ਲੋਕਲ ਜੋ ਲੋਕਾਂ ਦਾ ਚੱਲ ਰਿਹਾ ਪਹਿਰਾਵਾ ਹੈ ਉਹ ਧਾਰਨ ਕਰਨਾ ਪੈਂਦਾ ਹੈ ਉੱਥੋਂ ਦਾ ਸੱਭਿਆਚਾਰ ਅਡੋਪਟ ਕਰਨਾ ਪੈਂਦਾ ਹੈ ਅਤੇ ਇਸ ਤਰ੍ਹਾਂ ਜੋ ਲੜਾਈਆਂ ਦੇ ਹਿ ਹਿੱਸੇ ਵਜੋਂ ਵੱਖ ਵੱਖ ਖੇਤਰਾਂ ਵਿੱਚ ਚਲੇ ਜਾਂਦੇ ਹਨ ਉਹ ਇਹਨਾਂ ਚੁਣੌਤੀਆਂ ਦਾ ਸਾਹਮਣਾ ਤਾਂ ਉਹ ਲਗਭਗ ਉਹਨਾਂ ਨੂੰ ਕਰਨਾ ਹੀ ਪੈਂਦਾ ਹੈ ਅਤੇ ਉਹ ਕਰ ਵੀ ਲੈਂਦੇ ਹਨ